ਹਾਂਜੀ ਭੰਗੜੇ ਦੀ ਪੰਜਾਬ ਵਿੱਚ ਕਾਫੀ ਮਹੱਤਤਾ ਹੈ ਕਿਉਂਕਿ ਭੰਗੜਾ ਇਸ ਸਮੇਂ 'ਤੇ ਪੰਜਾਬ ਦਾ ਇੱਕ ਲੋਕ ਨਾਚ ਬਣ ਚੁੱਕਿਆ ਹੈ ਭੰਗੜੇ ਤੋਂ ਬਿਨਾਂ ਹਰ ਤਿਉਹਾਰ ਫਿੱਕਾ ਜਾਪਦਾ ਹੈ ਚਾਹੇ ਉਹ ਕੋਈ ਕਿਸੇ ਬੱਚੇ ਦਾ ਜਨਮ ਹੋਵੇ ਚਾਹੇ ਕਿਸੇ ਦਾ ਵਿਆਹ ਹੋਵੇ ਚਾਹੇ ਕੋਈ ਹੋਰ ਵੀ ਘਰ ਦੀ ਖੁਸ਼ੀ ਹੋਵੇ ਚਾਹੇ ਕੋਈ ਬਾਹਰ ਜਾ ਰਿਹਾ ਹੋਵੇ ਚਾਹੇ ਕੋਈ ਦੇਸ਼ ਤੋਂ ਆ ਰਿਹਾ ਹੋਵੇ ਉਹ ਸਾਰੇ ਭੰਗੜੇ ਨਾਲ ਹੀ ਸਵਾਗਤ ਕਰਦੇ ਹਨ ਕਿਉਂਕਿ ਭੰਗੜਾ ਦਿਲ ਦੀ ਖੁਸ਼ੀ ਬਾਹਰ ਕੱਢਣ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਭੰਗੜਾ ਸਾਡੇ ਦੇਸ਼ ਦਾ ਬਹੁਤ ਵਧੀਆ ਨਾਚ ਮੰਨਿਆ ਜਾਂਦਾ ਹੈ ਦੁਨੀਆਂ ਇੱਕ ਪੰਜਾਬ ਵਿੱਚ ਹੀ ਨਹੀਂ ਭੰਗੜਾ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ ਚਾਹੇ ਉਹ ਬਾਹਰਲੇ ਦੇਸ਼ ਹੋਣ ਕਈ ਸਾਡੇ ਪੰਜਾਬੀ ਗਾਇਕਾ ਪੰਜਾਬੀ ਸੰਗੀਤਕਾਰ ਜਾ ਜਾ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਭੰਗੜੇ ਨੂੰ ਬਹੁਤ ਪ੍ਰਚਲਿਤ ਕਰਦੇ ਹਨ ਕਿਉਂਕਿ ਭੰਗੜਾ ਬਹੁਤ ਵਧੀਆ ਨਾਚ ਹੈ ਇਸ ਨਾਲ ਭੰਗੜਾ ਬਹੁਤ ਵਧੀਆ